ਯੋਗਾ ਸਿੱਖਣ ਦੇ ਲਈ ਮੈਂ ਚੈਨਲ ਵੇਖਦਾ ਪਰ ਯੋਗਾ ਸਿੱਖਣ ਲਈ ਮੈਂ ਕੋਈ ਵਿਸ਼ੇਸ਼ ਚੈਨਲ ਨਹੀਂ ਵੇਖਦਾ ਯੂਟੀਊਬ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਚੈਨਲ ਆ ਤਰ੍ਹਾਂ ਤਰ੍ਹਾਂ ਦੀਆਂ ਐਕਸਰਸਾਈਜ਼ ਆ ਕਿਸੇ ਇਕ ਚੈਨਲ ਦੇ ਉੱਤੇ ਵੱਖਰੀ ਤਰ੍ਹਾਂ ਦਾ ਯੋਗਾ ਇੱਕ ਇੱਕ ਯੋਗਾ ਨੂੰ ਵੀ ਕਈ ਵਾਰ ਵੱਖਰੀ ਢੰਗ ਨਾਲ ਦਿਖਾਇਆ ਜਾਂਦਾ ਹੈ ਨਾ ਤਾਂ ਮੈਂ ਵਿਸ਼ੇਸ਼ ਤੌਰ ਦੇ ਉੱਤੇ ਕੋਈ ਚੈਨਲ ਨਹੀਂ ਵੇਖਦਾ ਅਤੇ ਪਰ ਮੈਂ ਯੋਗਾ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਵੀਡੀਓਜ਼ ਯੂਟਿਊਬ ਦੇ ਉੱਤੇ ਦੇਖਣ ਨੂੰ ਮਿਲਦੀਆਂ ਨੇ ਮੈਨੂੰ ਉਹਨਾਂ ਨੂੰ ਮੈਂ ਵੇਖਦਾ ਹਾਂ ਅਤੇ ਯੋਗਾ ਸਿੱਖਣ ਦੌਰਾਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਕਿਹਨਾਂ ਲੋਕਾਂ ਨੂੰ ਕਰਨਾ ਪੈਂਦਾ ਉਹਨਾਂ ਲੋਕਾਂ ਨੂੰ ਕਰਨਾ ਪੈਂਦਾ ਜਿਹੜੇ ਲੋਕ ਇਹਦੇ ਵਿੱਚ ਬਿਲਕੁਲ ਅਣ ਅਣਜਾਣ ਹੁੰਦੇ ਹਨ ਜਾਂ ਉਹ ਲੋਕ ਜਿਹੜੇ ਲੋਕਾਂ ਦੀ ਸਿਹਤ ਆ ਜਿਹੜੀ ਉਹ ਉਹਨਾਂ ਦੇ ਸਧਾਰਨ ਸਿਹਤ ਤੋਂ ਆਸਾਧਾਰਨ ਸਿਹਤ ਵੱਲ ਜਿਹੜੇ ਹੁੰਦੇ ਨੇ ਜਿਹੜੇ ਲੋਕ ਬਹੁਤ ਜ਼ਿਆਦਾ ਮੋਟੇ ਨੇ ਮੋਟਾਪੇ ਦੇ ਵਿੱਚ ਨੇ ਜਿਹੜੇ ਬਹੁਤ ਜ਼ਿਆਦਾ ਅਨਫਿਟ ਨੇ ਉਹਨਾਂ ਸਾਰੇ ਲੋਕਾਂ ਨੂੰ ਯੋਗਾ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਬੈਠਣ ਦੇ ਵਿੱਚ ਦਿੱਕਤ ਆਉਂਦੀ ਹੈ ਯੋਗਾ ਪੂਰੇ ਦਾ ਪੂਰਾ ਜਿਹੜਾ ਉਹ ਫਲੈਕਸੀਬਿਲਿਟੀ ਦੇ ਉੱਪਰ ਹੀ ਹੁੰਦਾ ਤੁਸੀਂ ਆਪਣੀ ਬੋਡੀ ਨੂੰ ਜਿੰਨੇ ਵਧੀਆ ਢੰਗ ਦੇ ਨਾਲ ਸਟਰੈਚ ਕਰੋਗੇ ਮੋੜੋਗੇ ਉੰਨੇ ਵਧੀਆ ਢੰਗ ਦੇ ਨਾਲ ਹੀ ਯੋਗਾ ਹੋ ਸਕਦਾ ਯੋਗਾ ਦੇ ਨਾਲ ਨਾਲ ਕੀ ਆ ਕਿ ਸਭ ਤੋਂ ਵੱਧ ਜਿਹੜਾ ਤੁਹਾਨੂੰ ਧਿਆਨ ਗੱਲ ਦਾ ਧਿਆਨ ਰੱਖਣਾ ਪੈਂਦਾ ਉਹ ਖੁਦ ਧਿਆਨ ਦਾ ਹੀ ਹੈ ਤਾਂ ਜਿੰਨਾ ਬੰਦਾ ਮੋਟਾਪੇ ਦੇ ਵਿੱਚ ਹੈਲਦੀ ਹੋਊਗਾ ਉਹ ਉਸ ਕਸ਼ਟ ਦੇ ਵਿੱਚ ਹੀ ਧਿਆਨ ਦੀ ਪ੍ਰਕਿਰਿਆ ਵੱਲ ਨਹੀਂ ਜਾ ਪਾਉਂਦਾ ਤਾਂ ਯੋਗਾ ਦੇ ਵਿੱਚ ਸਰੀਰ ਨੂੰ ਸਟਰੈਚ ਕਰਨ ਤੋਂ ਇਲਾਵਾ ਧਿਆਨ ਦੇ ਵਿੱਚ ਵੀ ਜਿਹੜੀ ਆ ਉਹ ਬਹੁਤ ਮੁਸ਼ਕਿਲਾਂ ਨ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਕਰਨਾ ਪੈਂਦਾ ਅਤੇ ਇਸ ਲਈ ਸਰੀਰ ਜੇ ਜ਼ਿਆਦਾ ਸਹੀ ਪੁਜੀਸ਼ਨ ਦੇ ਵਿੱਚ ਸਹੀ ਅਵਸਥਾ ਦੇ ਵਿੱਚ ਹੋਏਗਾ ਅਤੇ ਯੋਗਾ ਕਰਨ ਆਸਾਨ ਹੋਵੇਗਾ ਧੰਨਵਾਦ